ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕਿਵੇਂ ਹੋ ਆਪਾਂ ਵੀ ਵਧੀਆ ਤੁਸੀਂ ਦੱਸੋ ਹੁਣ ਤੁਸੀਂ ਕੱਲ੍ਹ ਫਰੀ ਹੋ ਕੱਲ੍ਹ ਤੁਸੀਂ ਵਿਹਲੇ ਹੋ ਮਤਲਬ ਤੁਹਾਨੂੰ ਇਹ ਕੰਮ ਪੈ ਰਿਹਾ ਸੀ ਸਾਡੇ ਨਾਲ ਇੱਧਰੋਂ ਨਵਾਂ ਇੱਕ ਕੰਮ ਆਇਆ ਜੀਐਨਏ ਦੇ ਬੱਚਿਆਂ ਨੇ ਸਾਡੇ ਜੀਐਨਏ ਦੇ ਬੱਚੇ ਸਾਨੂੰ ਆ ਕੇ ਮਿਲੇ ਅਤੇ ਉਹਨਾਂ ਨੇ ਕਿਹਾ ਇੱਕ ਓਥੇ ਓ ਲੱਗਦਾ ਓ ਤਿਉਹਾਰ ਟਾਈਪ ਉਹ ਮਨਾ ਰਹੇ ਉੱਥੇ ਉੱਥੇ ਇਹਨਾਂ ਨੇ ਜਾਣਾ ਅਤੇ ਨਾਲ ਉਹਨਾਂ ਦੇ ਨਾਲ ਪ੍ਰੋਫੈਸਰ ਵਗੈਰਾ ਜਾਊਗੇ ਇਸ ਕਰਕੇ ਆਪਾਂ ਨੇ ਜੀਐਨਈ ਤੋਂ ਸਾਹਨੇਆਲ ਜਾਣਾ ਆ ਸਾਹਨੇਆਲ ਜਿਹੜਾ ਪ੍ਰੋਗਰਾਮ ਹੈਗਾ ਸਾਡਾ ਸਾਹਨੇਆਲ ਹੈਗਾ ਏ ਅਤੇ ਜੀਐਨਈ ਦੇ ਬੱਚੇ ਚੱਕਣੇ ਆਪਾਂ ਵੀਰੇ ਇਹ ਆਪਣਾ ਹੈਗਾ ਆਪਾਂ ਜੀਐਨਈ ਤੋਂ ਆਪਾਂ ਸਾਢੇ ਪੰਜ ਵਜੇ ਨਿਕਲਣਾ ਅਤੇ ਆਪਾਂ ਸਾਹਨੇਵਾਲ ਤੋਂ ਪੰਜ ਵਜੇ ਉੱਥੋਂ ਨਿਕਲਣਾ ਅਤੇ ਸਾਨੂੰ ਸਾਨੂੰ ਬੱਸ ਲੈ ਗਏ ਪੰਤਾਲੀ ਮਿੰਟ ਪਹਿਲੇ ਆਉਣਾ ਪੈਣਾ ਕਿਉਂਕਿ ਬੱਚੇ ਅੱਧੇ ਘੰਟੇ ਪਹਿਲਾਂ ਆ ਜੂਗੇ ਅਤੇ ਆਪਾਂ ਹੁਣ ਰੂਟ ਕਿਹੜਾ ਲਈਏ ਤੁਹਾਡੇ ਹਿਸਾਬ ਨਾਲ ਰੂਟ ਕਿਹੜਾ ਲੈ ਸਕਦੇ ਹਾਂ ਆਪਾਂ

ਵੀਰ ਜੀ ਤੁਸੀਂ ਮੇਰੇ ਹਿਸਾਬ ਨਾਲ ਆਹ ਕਹਿਣ ਦੀ ਕੋਸ਼ਿਸ਼ ਕਰਦੇ ਹੋ ਕਿ ਆਪਾਂ ਪਹਿਲਾਂ ਜੀਐਨਏ ਤੋਂ ਨਹਿਰ ਦੇ ਜਾਵਾਂਗੇ ਨਹਿਰ ਤੋਂ ਅਰੋੜਾ ਪੈਲਿਸ ਅਰੋੜਾ ਪੈਲਿਸ ਤੋਂ ਫਿਰ ਗਿੱਲ ਚੌਂਕ ਗਿੱਲ ਚੋਂਕ ਤੋਂ ਢੋਲੇਵਾਲ ਚੋਂਕ ਢੋਲੇਵਾਲ ਚੋਂਕ ਤੋਂ ਫਿਰ ਚੀਮਾ ਚੋਂਕ ਆ ਜਾਂਦਾ ਅਤੇ ਚੀਮਾ ਚੋਂਕ ਪਹਿਲਾਂ ਆ ਜਾਂਦਾ ਚੀਮਾ ਚੋਂਕ ਤੋਂ ਬਾਅਦ ਚੋਂਕ ਉਹਤੋਂ ਬਾਅਦ ਇੰਡਸਟਰੀਅਲ ਏਰੀਆ ਆ ਜਾਂਦਾ ਇੰਡਸਟਰੀਅਲ ਏਰੀਆ ਤੋਂ ਬਾਅਦ ਫਿਰ ਜਾ ਕੇ ਆਪਣਾ ਸਾਹਨੇਆਲ ਆਉਂਦਾ ਸਾਹਨੇਆਲ ਦੇ ਵਿੱਚ ਚੰਡੀਗੜ ਰੋਡ ਦੇ ਵਿੱਚ ਆ ਜਾਣੀ ਆ ਉੱਥੇ ਸਾਨੂੰ ਟਰੈਫਿਕ ਬਹੁਤ ਮਿਲ ਜਾਣਾ ਹੈਗਾ ਇਹ ਤੁਹਾਡੇ ਹਿਸਾਬ ਨਾਲ ਟਰੈਫਿਕ ਹੁਣ ਟਰੈਫਕ ਘਟਾਉਣ ਵਾਸਤੇ ਕਿਉਂਕਿ ਤਿਉਹਾਰ ਦਾ ਟਾਈਮ ਚੱਲਦਾ ਆ ਸਵੇਰੇ ਸਵੇਰੇ ਆਪਾਂ ਆਪਾਂ ਸਵੇਰੇ ਸਵੇਰੇ ਟਾਈਮ ਸਿਰ ਪਹੁੰਚ ਜਾਂਗੇ ਪਰ ਨਿਆਣਿਆਂ ਨੂੰ ਸ਼ਾਮੀ ਆਉਣ ਵੇਲੇ ਟਾਈਮ ਲੱਗ ਜਾਣਾ ਅਗਰ ਆਪਾਂ ਉਹ ਤੋਂ ਪੰਜ ਵਜੇ ਨਿਕਲੇ ਕੋਲਜ ਸਾਨੂੰ ਛੇ ਵਜੇ ਤਾਂ ਪੁੱਜਣਾ ਪੈਣਾ ਛੇ ਜਾਂ ਸਾਢੇ ਛੇ ਸੱਤ ਮੰਨ ਲਓ ਟਰੈਫਿਕ ਮਿਲ ਗਿਆ ਤਾਂ ਆਪਾਂ ਨੌ ਦਸ ਵਜੇ ਪੁੱਜਾਂਗੇ ਅਤੇ ਬੱਚਿਆ ਨੂੰ ਵੀ ਥੋੜ੍ਹਾ ਔਖਾ ਹੋ ਜੂਗਾ ਘਰਦਿਆਂ ਦਾ ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਤੋਂ ਕੋਈ ਹੋਰ ਸੌਖਾ ਰਾਹ ਹੋਵੇਗਾ ਜਿੰਨਾਂ ਛੇਤੀ ਪਹੁੰਚ ਜਾਈਏ ਅਤੇ ਟਰੈਫਿਕ ਵੀ ਨਾ ਮਿਲੇ ਇੱਧਰਲਾ ਮੇਰੇ ਹਿਸਾਬ ਨਾਲ ਰੋਡ ਆਪਾਂ ਇੱਕ ਆਪਾਂ ਗਿੱਲ ਨਹਿਰ ਆਲੀ ਸਾਇਡ ਆਤਮ ਪਾਰਕ ਤੋਂ ਆਪਾਂ ਉੱਧਰਲੀ ਸਾਈਡ ਲੁਧਿਆਣੇ ਤੋਂ ਬਾਹਰੋਂ ਕੱਢ ਲਈਏ ਤਾਂ ਗੱਲ ਬਣ ਸਕਦੀ ਆ ਆਪਣੀ ਪੈਟਰੋਲ ਹੋਵੇਗਾ ਇੰਨਾਂ ਗੱਡੀ 'ਚ ਤੁਹਾਡੇ ਕੋਲ ਤੁਹਾਡੀ ਗੱਡੀ ਚੱਕਦੀ ਕਿੰਨੀ ਆ ਕਿੰਨੇ ਕੁ ਕਿਲੋਮੀਟਰ ਚੱਕ ਲੈਂਦੀ ਆ ਸਾਡਾ ਰੂਟ ਤੀਹ ਕਿਲੋਮੀਟਰ ਪੈ ਜਾਂਦਾ ਆਪਣਾ ਨਹੀਂ ਬਈ ਇਹ ਨਹੀਂ ਵੀਰ ਜੀ ਇਹ ਤਾਂ ਮੈਂ ਤੁਹਾਨੂੰ ਸਿੱਧਾ ਦੱਸ ਰਿਹਾ ਬਿਨਾਂ ਟਰੈਫਿਕ ਦੇ ਅਗਰ ਆਪਾਂ ਬਾਹਰੋਂ ਕੱਢਣਾ ਤਾਂ ਤਾਂ ਆਪਣੇ ਨੂੰ ਆਰਾਮ ਨਾਲ ਪਚਵੰਜਾ ਕਿਲੋਮੀਟਰ ਲੱਗ ਜਾਣਾ ਪਰ ਛੇਤੀ ਪਹੁੰਚ ਜਾਂਗੇ ਆਪਾਂ ਤੁਹਾਡਾ ਵੀ ਅਤੇ ਤੁਹਾਡਾ ਪੈਟਰੋਲ ਦਾ ਖਰਚਾ ਕਿੰਨਾ ਕੁ ਹੋਵੇਗਾ ਬਾਰ੍ਹਾਂ ਤੇਰ੍ਹਾਂ ਸੌ ਵੀਰ ਤੁਸੀਂ ਘੱਟ ਕਹਿ ਰਹੇ ਹੋ ਮੇਰੇ ਹਿਸਾਬ ਨਾਲ ਤੁਹਾਡਾ ਆਰਾਮ ਨਾਲ ਪੰਜ ਕ ਹਜ਼ਾਰ ਦਾ ਖਰਚਾ ਆ ਜਾਣਾ ਮੈਂ ਤੁਹਾਨੂੰ ਮੈਂ ਤੁਹਾਨੂੰ ਤੀਹ ਕਿਲੋਮੀਟਰ ਦਾ ਰੂਟ ਨੇ ਦੱਸਿਆ ਕਹਿ ਰਿਹਾ ਮੈਂ ਪਚਵੰਜਾ ਕਿਲੋਮੀਟਰ ਵਾਲਾ ਕਹਿ ਰਿਹਾ ਹੁਣ ਤੁਹਾਨੂੰ ਆਪਣੇ ਬੱਚੇ ਕਿਹੜੇ ਜਾਣੇ ਆ ਇੱਕ ਆਪਣਾ ਜੀਐਨਏ ਤੋਂ ਪਹਿਲਾਂ ਚੱਕਣਾ ਆ ਆਪਾਂ ਦਸ ਬੱਚੇ ਇਹ ਨਹਿਰ 'ਤੇ ਆਪਣੇ ਦੋ ਬਚੇ ਖੜ੍ਹੇ ਹੋਊਗੇ ਅਤੇ ਆਪਾਂ ਜਾਣਾ ਆਤਮ ਪਾਰਕ ਵਾਲੀ ਸਾਈਡ ਆਤਮ ਪਾਰਕ ਆਪਾਂ ਦੋ ਬੱਚੇ ਚੱਕਣੇ ਆ ਅਤੇ ਆਤਮ ਪਾਰਕ ਤੋਂ ਜਾਣਾ ਆਪਾਂ ਅਰੋੜਾ ਪੈਲਿਸ ਉੱਥੇ ਦੋ ਬੱਚੇ ਹੈਗੇ ਆ ਅਤੇ ਅਰੋੜਾ ਪੈਲਸ ਤੋਂ ਗਿੱਲ ਚੋਂਕ ਗਿੱਲ ਚੋਂਕ ਅਤੇ ਆਪਣੇ ਮੋਡਲ ਟਾਊਨ ਵਾਲੀ ਸਾਈਡ ਪਤਾ ਤੁਹਾਨੂੰ ਹਾਂ ਮੋ ਮੋਡਲ ਟਾਊਨ ਵਾਲੀ ਸਾਈਡ ਜਾ ਕੇ ਆਪਾਂ ਉੱਧਰੋਂ ਦੋ ਪਾਸੇ ਚੱਕਣੇ ਉਧਰੋਂ ਦੁਬਾਰਾ ਆ ਕੇ ਆਪਣੇ ਮੇਨ ਪੁਆਇੰਟ 'ਤੇ ਆ ਗਏ ਜਿੱਥੋਂ ਆਪਾਂ ਲੁਧਿਆਣੇ ਤੋਂ ਬਾਹਰ ਜਾਣਾ ਆ ਉੱਥੇ ਵੀ ਆਪਾਂ ਸਾਹਨੇਆਲ ਜਾਣਾ ਆ ਦੁਬਾਰਾ ਘੁੰਮ ਕੇ ਆਉਣਾ ਆਪਾਂ ਘੁੰਮ ਕੇ ਆਉਣਾ ਪਹਿਲਾਂ ਜੀਐਨਈ ਤੋਂ ਚੀਮਾ ਮੋਡਲ ਟਾਊਨ ਜਾਣਾ ਮੋਡਲ ਟਾਊਨ ਜੀਐਨਈ ਦੇ ਦੇ ਕੋਲ ਦੁਬਾਰਾ ਆਉਣਾ ਏ ਅਤੇ ਅਤੇ ਤੁਸੀਂ ਇਹ ਰੂਟ ਕਰ ਲੋਂਗੇ ਨਾ ਅਤੇ ਆਪਾਂ ਤੁਸੀਂ ਚਾਰ ਪੰਤਾਲੀ ਤੱਕ ਆ ਜਿਓ ਆਪਾਂ ਨਹੀਂ ਚਾਰ ਚਾਰ ਪੰਤਾਲੀ ਚਾਰ ਪੰਦਰ੍ਹਾਂ ਤੱਕ ਆਇਓ ਪੰਜ ਵਜੇ ਤੋਂ ਨਿਕਲਣਾ ਆਪਾਂ ਇੱਥੋਂ ਦੀ ਓਕੇ ਵੀਰ ਜੀ